ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਕ ਆ ਮੈਂ ਜ਼ਿਆਦਾਤਰ ਬਹੁਤ ਦਿਨ ਬਹੁਤ ਦੂਰ ਚਲ ਜਾ ਚਲ ਜਾਂਦਾ ਵਾ ਇੱਕ ਵਾਰੀ ਮੈਂ ਮਹਾਂਕੁੰਭ ਗਿਆ ਸੀ ਓਥੇ ਅਸੀਂ ਸਾਰੇ ਦੋਸਤਾਂ ਨਾਲ ਗਏ ਸੀ ਅਸੀਂ ਓਥੇ ਬਾਈਕਾਂ ਵਿੱਚ ਗਏ ਸੀ ਅਤੇ ਅਸੀਂ ਓਥੇ ਬੜੇ ਮਜ਼ੇ ਕੀਤੇ ਅਸੀਂ ਆਪਣਾ ਤੰਬੂ ਲੈ ਕੇ ਗਏ ਸੀ ਨਾਲ ਅਸੀਂ ਓਥੇ ਪਹਿਲਾਂ ਮੱਥਾ ਮੁਥਾ ਟੇਕਿਆ ਸੀ ਨਹਾ ਨਹੂ ਕੇ ਅਸੀਂ ਡੁੱਬਕੀਆਂ ਲੈ ਕੇ ਅਸੀਂ ਆਪਣਾ ਤੰਬੂ ਲਾਇਆ ਅਤੇ ਅਸੀਂ ਤੰਬੂ 'ਚ ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਵੀ ਹੋਈਆਂ ਅਤੇ ਸਾਨੂੰ ਬਹੁਤ ਜ਼ਿਆਦਾ ਮਜ਼ਾ ਵੀ ਆਇਆ ਜਦੋਂ ਅਸੀਂ ਤੰਬੂ ਲਾਇਆ ਸਾਨੂੰ ਤੰਬੂ ਲਾਉਣ 'ਚ ਵੀ ਬੜੀ ਦਿੱਕਤ ਆਈ ਅਤੇ ਅਸੀਂ ਜਦੋਂ ਤੰਬੂ 'ਚ ਰਹੇ ਸਾਨੂੰ ਖਾਣ ਪੀਣ ਦੀ ਥੋੜ੍ਹੀ ਦਿੱਕਤ ਸੀਗੀ ਅਤੇ ਬੜਾ ਕੰਜਸਟਡ ਜਿਹਾ ਹੋ ਜਾਂਦਾ ਵਾ ਬੜਾ ਅਲੱਗ ਜਿਹਾ ਹੋ ਜਾਂਦਾ ਵਾ ਤੰਬੂਆਂ 'ਚ ਰਹਿਣਾ ਅਸੀਂ ਕਦੇ ਤੰਬੂਆਂ 'ਚ ਨਹੀਂ ਰਹੇ ਤੰਬੂਆਂ 'ਚ ਰਹਿਣ ਦਾ ਰਹਿਣਾ ਮਹਿਸੂਸ ਥੋੜ੍ਹਾ ਜਿਹਾ ਅੱਛਾ ਵੀ ਹੁੰਦਾ ਵਧੀਆ ਵੀ ਹੁੰਦਾ ਔਖਾ ਵੀ ਹੁੰਦਾ ਵਾ ਅਤੇ ਜਦੋਂ ਅਸੀਂ ਤੰਬੂਆਂ 'ਚ ਰਹਿੰਦੇ ਹਾਂ ਅਤੇ ਸਾਨੂੰ ਬੜੀ ਚੀਜ਼ਾਂ ਦਾ ਪਤਾ ਵੀ ਲੱਗਦਾ ਵਾ ਸਾਨੂੰ ਤੰਬੂ 'ਚ ਰਹਿ ਕੇ ਬੜੀਆਂ ਚੀਜ਼ਾਂ ਦਾ ਪਤਾ ਲਗਦਾ ਵਾ ਕਿੱਦਾਂ ਰਹਿਣਾ ਸਹਿਣਾ ਕਿੱਦਾਂ ਪਹਿਲਾਂ ਲੋਕ ਰਹਿੰਦੇ ਸੀ ਤੰਬੂਆਂ 'ਚ ਬੜਾ ਓਦਾਂ ਪਤਾ ਲੱਗਦਾ ਸੀ